ਭਾਰਤ ਵਿੱਚ ਮੁੱਖ ਤੌਰ ਦੇ ਉੱਤੇ ਚਾਰ ਪਾਰਟੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਬੀ ਜੇ ਪੀ ਅਕਾਲੀ ਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਤਿੰਨ ਪਾਰਟੀਆਂ ਰਾਸ਼ਟਰੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਉਹ ਰਾਜ ਦੀ ਪਾਰਟੀ ਹੈ ਛੋਟੀ ਪਾਰਟੀ ਹੈ ਪਰ ਪੰਜਾਬ ਦੇ ਵਿੱਚ ਇਹਨਾਂ ਚਾਰ ਪਾਰਟੀਆਂ ਦਾ ਆਪਸ ਮੇਂ ਪੂਰਾ ਬਰਾਬਰ ਦਬਦਬਾ ਚਾਰ ਪਾਰਟੀਆਂ ਇੱਕ ਦੂਜੇ ਤੋਂ ਵੱਧ ਕੇ ਜਿਹੜੇ ਹੈਗੀਆਂ ਨੇ ਉਹ ਸੀਟਾਂ ਲੈਂਦੀਆਂ ਨੇ ਪਿਛੇ ਜਿਹੇ ਪਹਿਲਾਂ ਦੋ ਹਜ਼ਾਰ ਸਤਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਉਹ ਸੌ ਸੀਟਾਂ ਲੈ ਕੇ ਸਰਕਾਰ ਬਣਾਵੇਗੀ ਪਰ ਇਹਨਾਂ ਨੂੰ ਸਿਰਫ਼ ਬਾਈ ਸੀਟਾਂ ਆਈਆਂ ਤਾਂ ਉਦੋਂ ਕਾਂਗਰਸ ਨੇ ਇੱਥੇ ਸਰਕਾਰ ਬਣਾਈ ਅਤੇ ਇਸ ਤਰ੍ਹਾਂ ਜਿਹੜੀ ਹੈਗੀ ਹੈ ਦੋ ਹਜ਼ਾਰ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੰਨਵੇਂ ਸੀਟਾਂ ਲਈਆਂ ਅਤੇ ਸਰਕਾਰ ਬਣਾਈ ਜਿਹੜੇ ਇਹਨਾਂ ਦੇ ਮੋਟੋ ਨੇ ਬੇਸਿਕਲੀ ਆਮ ਆਦਮੀ ਪਾਰਟੀ ਦਾ ਮੋਟੋ ਹੈ ਬਿਲਕੁਲ ਥੱਲੜੇ ਲੈਵਲ ਦੇ ਬੰਦੇ ਨੂੰ ਉੱਪਰ ਲੈ ਕੇ ਜਾਣਾ ਆਮ ਸ਼ਖਸੀਅਤ ਆਮ ਬੰਦੇ ਨੂੰ ਮਤਲਬ ਉਸ ਲੈਵਲ 'ਤੇ ਪਹੁੰਚਾ ਕੇ ਉਸ ਲੈਵਲ 'ਤੇ ਪਹੁੰਚਾਉਣਾ ਜਿਹੜੇ ਲੈਵਲ 'ਤੇ ਆਮ ਬੰਦਾ ਸੋਚ ਨਹੀਂ ਸਕਦਾ ਭਾਵ ਕਿ ਇੱਕ ਬੰਦੇ ਨੂੰ ਐਮ ਐਲ ਏ ਬਣਾਉਣਾ ਇੱਕ ਆਮ ਬੰਦੇ ਨੂੰ ਮੰਤਰੀ ਬਣਾਉਣਾ ਇੱਕ ਆਮ ਬੰਦੇ ਨੂੰ ਮੁੱਖ ਮੰਤਰੀ ਬਣਾਉਣਾ ਇਹ ਇਹਨਾਂ ਦੇ ਖ਼ਾਸ ਏਜੰਡੇ 'ਤੇ ਹੈ ਜਦੋਂ ਕੋਈ ਦੂਜੀਆਂ ਪਾਰਟੀਆਂ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਇਹਨਾਂ ਦਾ ਆਪੋ ਆਪਣਾ ਮੋਟੋ ਹੈ ਇਹ ਵੀ ਲੋਕਾਂ ਨਾਲ ਜੁੜੇ ਹੋਏ ਬਹੁਤ ਜੋ ਕ ਲੋਕਾਂ ਨਾਲ ਜੁੜੇ ਹੋਏ ਨੇ ਇਹਨਾਂ ਦੇ ਵੀ ਬਹੁਤ ਵਰਕਰ ਨੇ ਜਿਹੜੇ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਜਦੋਂ ਜ਼ਰੂਰਤ ਹੁੰਦੀ ਹੈ ਕਿਸੇ ਇਕੱਠ ਕਰਨ ਦੀ ਤਾਂ ਉੱਥੇ ਇਹਨਾਂ ਦਾ ਵੀ ਓਡੇ ਵੱਡੇ ਪੱਧਰ 'ਤੇ ਉਨੇ ਵੱਡੇ ਪੱਧਰ 'ਤੇ ਹੀ ਇਕੱਠ ਕਰਤ ਹੁੰਦਾ ਹੈ ਅਤੇ ਉੱਥੇ ਪੂਰੇ ਜਾਲੋ ਜਹੌਲ ਨਾਲ ਇਹ ਪੂਰੇ ਇਕੱਠ ਦੇ ਵਿੱਚ ਆਪਣੀ ਜਿਹੜੀ ਹੈਗੀ ਸ਼ਖਸੀਅਤਾਂ ਨੂੰ ਅਤੇ ਆਪਣੀ ਜਿਹੜੀ ਇੱਥੇ ਤਾਕਤ ਹੈ ਉਹਨੂੰ ਦਿਖਾਉਂਦੇ ਆ ਲੋਕਾਂ ਦੇ ਵਿੱਚ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਇਹ ਇਹਨਾਂ ਦੇ ਵਿੱਚ ਪੂਰੀ ਮਤਲਬ ਪਾਰਟੀਆਂ ਦੇ ਵਿੱਚ ਇੱਕ ਤਰ੍ਹਾਂ ਦੀ ਦੌੜ ਹੁੰਦੀ ਹੈ ਇੱਕ ਤਰ੍ਹਾਂ ਦਾ ਜੋਰ ਆਜ਼ਮਾਇਸ਼ ਹੁੰਦਾ ਹੈ ਇਸ ਜੋਰ ਆਜ਼ਮਾਇਸ਼ ਦੇ ਵਿੱਚ ਕਦੇ ਕਾਂਗਰਸ ਅੱਗੇ ਅਤੇ ਕਦੇ ਅਕਾਲੀ ਦਲ ਅੱਗੇ ਪਰ ਇਸ ਵਾਰ ਬੀ ਜੇ ਪੀ ਕਾਂਗਰਸ ਅਤੇ ਅਕਾਲੀ ਦਲ ਤਿੰਨਾਂ ਨੂੰ ਪਛਾੜ ਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਸਰਕਾਰ ਬਣਾਈ ਹੈ ਸਰਕਾਰ ਬਣਾ ਕੇ ਦੋ ਸਾਲ ਲਗਭਗ ਹੋ ਗਏ ਸਰਕਾਰ ਚੱਲਦੀ ਨੂੰ ਆਮ ਲੋਕਾਂ ਦਾ ਕੀ ਰੁਝਾਨ ਹੈ ਇਸ ਪਾਰਟੀ ਦੇ ਪ੍ਰਤੀ ਉਹ ਤਾਂ ਆਉਣ ਵਾਲਾ ਟੈਮ ਹੀ ਦੱਸੇਗਾ ਧੰਨਵਾਦ